ਮੈਂ ਕੇਨੈਡਾ ਜਾਣਾ ਚਾਹੁੰਦੀ ਸੀ ਅਤੇ ਉੱਥੇ ਜੌਬ ਕਰਨਾ ਚਾਹਦੀ ਸੀ ਪਰ ਹੁਣ ਮੈਨੂੰ ਉੱਥੇ ਕੈਨੇਡਾ ਵਿੱਚ ਬਿਜਨਸ ਬਹੁਤ ਵਧੀਆ ਬਿਜ਼ਨਸ ਮਿਲ ਗਿਆ ਹੈ ਜਿੱਥੇ ਮੈਂ ਬਹੁਤ ਵਧੀਆ ਬਿਜ਼ਨਸ ਕਰ ਰਹੀ ਹਾਂ ਮੈਂ ਕਾਫੀ ਪੈਸਾ ਵੀ ਕਮਾ ਰਹੀ ਹਾਂ ਮੈਂ ਆਪਣੇ ਪਰਿਵਾਰ ਨੂੰ ਵੀ ਉੱਥੇ ਬੁਲਾ ਲਿਆ ਹੈ ਇਹ ਮੇਰੇ ਮਾਤਾ ਪਿਤਾ ਲਈ ਵੀ ਮਾਣ ਦੀ ਗੱਲ ਹੈ ਇਹ ਮੇਰੇ ਲ ਲਈ ਬਹੁਤ ਵੱਡੀ ਪ੍ਰਾਪਤੀ ਹੈ